ਹੈਲੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪਿੰਕੀ ਆ ਮੈਂ ਸਲਾਮਾਬਾਦ ਮੁਹੱਲੇ 'ਚ ਰਹਿੰਦੀ ਹਾਂ ਗੁਰਦਾਸਪੁਰ 'ਚ ਅਤੇ ਇਸ ਤਰ੍ਹਾਂ ਮੈਨੂੰ ਪਤਾ ਚੱਲਿਆ ਕਿ ਯੋਗਾ ਦਾ ਯੋਗਾ ਬਾਰੇ ਮੈਂ ਨਾ ਟੀ ਵੀ ਲਗਾਇਆ ਅਤੇ ਟੀ ਵੀ ਵਿੱਚ ਮੈਨੂੰ ਮੈਂ ਦੇਖਿਆ ਬਾਬਾ ਰਾਮਦੇਵ ਜੀ ਯੋਗਾ ਕਰਦੇ ਅਤੇ ਮੈਂ ਮਤਲਬ ਕਿ ਡੇਲੀ ਦੇਖਣਾ ਸਟਾਰਟ ਕੀਤਾ ਅਤੇ ਮੈਨੂੰ ਵੀ ਸ਼ੌਕ ਪੈ ਗਿਆ ਕਿ ਯੋਗਾ ਕਰਨ ਦਾ ਅਤੇ ਮੈਂ ਪਹਿਲਾਂ ਥੋੜ੍ਹਾ ਥੋੜ੍ਹਾ ਮਤਲਬ ਕਿ ਸਟਾਰਟ ਕੀਤਾ ਯੋਗਾ ਕਰਨਾ ਅਤੇ ਫਿਰ ਮੈਨੂੰ ਬਹੁਤ ਜ਼ਿਆਦਾ ਸ਼ੌਕ ਪੈ ਗਿਆ ਯੋਗਾ ਕਰਨ ਦਾ ਅਤੇ ਮੈਂ ਫਿਰ ਹੌਲੀ ਹੌਲੀ ਮੈਂ ਵੀ ਪ੍ਰੇਰਿਤ ਹੋ ਗਈ ਯੋਗਾ ਵਿੱਚ ਅਤੇ ਮੈਂ ਯੋਗਾ ਫਿਰ ਮੈਂ ਮੈਂ ਵੀ ਮਤਲਬ ਕਿ ਰੋਜ਼ ਡੇਲੀ ਸਵੇਰੇ ਉੱਠ ਕੇ ਅਤੇ ਯੋਗਾ ਕਰਨ ਦੀ ਮਤਲਬ ਕਿ ਕੋਸ਼ਿਸ਼ ਕੀਤੀ ਅਤੇ ਮੈਂ ਵੀ ਪ੍ਰੇਰਿਤ ਹੋ ਗਈ ਯੋਗਾ ਕਰਨ 'ਚ ਮੈਨੂੰ ਵਧੀਆ ਲੱਗਿਆ ਯੋਗਾ ਕਰਨਾ ਕਰਨਾ ਅਤੇ ਮੈਂ ਇਸ ਕਰਕੇ ਮੈਂ ਯੋਗਾ ਕਰਨਾ ਮਤਲਬ ਕਿ ਰੋਜ਼ ਸਵੇਰੇ ਉੱਠ ਕੇ ਯੋਗਾ ਕਰਨਾ ਮੈਂ ਸਟਾਰਟ ਕਰ ਦਿੱਤਾ ਅਤੇ ਮੇਰਾ ਸਰੀਰ ਠੀਕ ਰਿਹਾ ਤੰਦਰੁਸਤ ਰਿਹਾ ਯੋਗਾ ਕਰਨ 'ਚ ਹੋਰ ਹੋਰ ਮੈਂ ਵਧੀਆ ਮੈਨੂੰ ਆਪਣੇ ਆਪ 'ਚ ਸਰੀਰ ਠੀਕ ਲੱਗਣ ਲੱਗ ਪਿਆ ਯੋਗਾ ਕਰਨ ਦੇ ਨਾਲ ਇਸ ਕਰਕੇ ਮੈਨੂੰ ਯੋਗਾ ਯੋਗਾ ਕਰਨ ਦਾ ਮੈਨੂੰ ਫਿਰ ਬਹੁਤ ਜ਼ਿਆਦਾ ਸ਼ੌਕ ਪੈ ਗਿਆ ਮੈਂ ਫਿਰ ਰੋਜ਼ ਕਰਨਾ ਸਟਾਰਟ ਕਰ ਦਿੱਤਾ ਯੋਗਾ ਕਰਨਾ